ਵਧੀਆ ਤੁਸੀਂ ਸੁਣਾਓ ਕਿਵੇਂ ਹੋ ਹਾਂਜੀ ਬੋਲੋ ਹਾਂ ਅੱਛਾ ਯਾਰ ਮੈਂ ਨਾ ਤਿੰਨ ਚਾਰ ਤਿੰਨ ਦੇਖਿਆ ਬਾਰੇ ਸਰਚ ਕੀਤੀ ਹੈ ਪਰ ਮੈਨੂੰ ਪਤਾ ਨਹੀਂ ਇਹ ਵਧੀਆ ਜਾਂ ਨਹੀਂ ਅੱਛਾ ਅੱਛਾ ਅੱਛਾ ਮੈਂ ਜਾ ਕੇ ਕੌਲਜ 'ਚ ਵਿਜ਼ਿਟ ਨਾ ਕਰ ਆਈਏ ਇੱਕ ਦਿਨ ਹਾਂ ਅੱਗੇ ਦਾ ਫੇਰ ਸੋਚਾਂਗੇ ਹੈ ਨਾ ਠੀਕ ਹਾਂ ਠੀਕ ਹੈ ਓਕੇ ਬਾਏ